ਕਿਰਾਏ ਵਾਲੀਆਂ ਬਾਈਕਾਂ ਜਿਵੇਂ ਸੈਂਕਲ ਚਲਾਉਣਾ ਸੈਂਕਲ ਚਲਾਉਣ ਨਾਲ ਬੰਦਾ ਬਹੁਤ ਵਧੀਆ ਅਤੇ ਤੰਦਰੁਸਤ ਰਹਿੰਦਾ ਹੈ ਤੁਸੀਂ ਕਿਸੇ ਦੂਜੇ ਸ਼ਹਿਰ ਵਿੱਚ ਜਾਉ ਜਿਹੜਾ ਤੁਹਾਨੂੰ ਸੈਂਕਲ ਸਿੱਕੇ ਦੇ ਕੇ ਪੈਸੇ ਦੇ ਕੇ ਕਿਰਾਏ 'ਤੇ ਮਿਲ ਜਾਂਦਾ ਹੈ ਤਾਂ ਤੁਸੀਂ ਉੱਥੇ ਕਿਸੇ ਵੀ ਕੰਮ ਜਾ ਸਕਦੇ ਹੋ ਤੁਹਾਨੂੰ ਕੋਈ ਟੈਕਸੀ ਕਰਵਾਉਣ ਦੀ ਜ਼ਰੂਰਤ ਨਹੀਂ ਤੇ ਸੈਂਕਲ ਸਫ਼ਰ ਕਰਨਾ ਵੀ ਬਹੁਤ ਸੌਖਾ ਅਤੇ ਵਧੀਆ ਲੱਗਦਾ ਹੈ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਨਾ ਹੀ ਕੋਈ ਗੋਡੇ ਲੱਤਾਂ ਬਾਹਾਂ ਨੂੰ ਥਕਾਵਟ ਆਉਂਦੀ ਹੈ ਅਤੇ ਸੈਂਕਲ ਸਰੀਰ ਦੇ ਵਿੱਚ ਸੌ ਬਿਮਾਰੀਆਂ ਦਾ ਫ਼ਾਇਦਾ ਕਰਦਾ ਹੈ ਇਹ ਸੈਂਕਲ ਚਲਾਉਣ ਨਾਲ ਹੋਰ ਵੀ ਬਹੁਤ ਬਹੁਤ ਸਰੀਰ ਨੂੰ ਵਧੀਆ ਰੱਖਦਾ ਹੈ ਸੈਂਕਲ ਚਲਾਉਣ ਨਾਲ ਬੰਦਾ ਤੰਦਰੁਸਤ ਅਤੇ ਵਧੀਆ ਵਧੀਆ ਆਪ ਨੂੰ ਮਹਿਸੂਸ ਕਰ ਇਸ ਨੂੰ ਅਸੀਂ ਬਹੁਤ ਵਧੀਆ ਦੇਖਦੇ ਹਾਂ ਸੈਂਕਲ ਚਲਾਉਣ ਵਾਲੇ ਜੋ ਵੀ ਲੋਕ ਸੈਂਕਲ ਨੂੰ ਚਲਾਉਂਦੇ ਹਨ ਉਹ ਸੈਂਕਲ ਦੀ ਬੈਠ ਤੋਂ ਬਹੁਤ ਹੀ ਵਧੀਆ ਆਪਣਾ ਸਫ਼ਰ ਤੈਅ ਕਰਦੇ ਹਨ ਸੈਕਲ ਸਾਨੂੰ ਸਿਹਤ ਲਈ ਬਹੁਤ ਹੀ ਚੰਗਾ ਹੈ ਅਤੇ ਸਾਨੂੰ ਇਸਦੀ ਵਰਤੋਂ ਹਰ ਰੋਜ਼ ਕਰਨੀ ਚਾਹੀਦੀ ਹੈ ਅਤੇ ਟੈਕਸੀਆਂ ਦੇ ਵਿੱਚ ਕਿਰਾਏ ਭਰਾਏ ਭਰਨ ਨਾਲੋਂ ਇਹ ਚੀਜ਼ ਸਾਨੂੰ ਬਹੁਤ ਵਧੀਆ ਹੀ ਹੈ ਇਸ ਲਈ ਸਾਨੂੰ ਸੈਂਕਲ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਹਰ ਰੋਜ਼ ਤੜਕੇ ਜਿਵੇਂ ਸੈਰ ਕਰੋ ਵਧੀਆ ਮਨ ਰਹਿੰਦਾ ਹੈ